ਆਪਣੇ ਖੇਤਰ ਵਿੱਚ ਕਈ ਲੜਾਈਆਂ ਅੰਤਰ ਭਾਈਚਾਰਕ ਲੜਾਈਆਂ ਦੇਖੀਆਂ ਜਿਵੇਂ ਹਿੰਦੂ ਮੁਸਲਮਾਨ ਸਿੱਖਾਂ ਦੀ ਲੜਾਈਆਂ ਇਹ ਰਾਜਨੀਤੀ ਲਈ ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਹੈ ਜੇਕਰ ਸਿੱਖਾਂ ਅਰ ਹਿੰਦੂਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਫੀ ਸਮੇਂ ਤੋਂ ਇਹਨਾਂ ਨੂੰ ਆਪਸ ਦੇ ਵਿੱਚ ਲੜਾਇਆ ਜਾਂਦਾ ਹੈ ਧਰਮ ਦੇ ਧਰਮ ਦੀ ਭਾਵਨਾ ਕਰਕੇ ਅਤੇ ਜੇਕਰ ਉੱਨੀ ਸੌ ਚੁਰਾਸੀ ਦੀ ਗੱਲ ਕੀਤੀ ਜਾਵੇ ਤਾਂ ਇਹ ਦੇਖਿਆ ਸੀਗਾ ਕਿ ਇੰਦਰਾ ਗਾਂਧੀ ਦੀ ਮੌਤ ਹੋ ਗਈ ਸੀਗੀ ਉਸ ਨੂੰ ਮਾਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਫਿਰ ਉੱਥੇ ਦਿੱਲੀ 'ਚ ਕਿੰਨਾ ਦੰਗਾ ਫਸਾਦ ਹੋਇਆ ਗਲ਼ਾਂ 'ਚ ਟੈਰ ਪਾ ਕੇ ਲੋਕ ਸਾੜੇ ਗਏ ਤਾਂ ਕਾਫੀ ਨੁਕਸਾਨ ਹੋਇਆ ਸੀਗਾ ਉਸ ਸਮੇਂ ਤਾਂ ਅੱਜ ਕੱਲ੍ਹ ਇਹ ਚਾਹੀਦਾ ਹੈ ਕਿ ਸਾਨੂੰ ਇਹ ਭੇਦ ਭਾਵ ਦੀ ਭਾਵਨਾ ਖਤਮ ਕਰਕੇ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਮਨਸ਼ਾ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਆਪਸੀ ਭਾਈਚਾਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ